ਵੈਸੇ ਤਾਂ ਮੈਨੂੰ ਪੰਜਾਬੀ ਦੇ ਬਹੁਤ ਸਾਰੇ ਲੇਖਕ ਬਹੁਤ ਜ਼ਿਆਦਾ ਪਸੰਦ ਨੇ ਪਰ ਉਹਨਾਂ ਵਿੱਚੋਂ ਖ਼ਾਸ ਕਰਕੇ ਦਲੀਪ ਕੌਰ ਟਿਵਾਣਾ ਮੈਨੂੰ ਬਹੁਤ ਪਸੰਦ ਨੇ ਕਿਉਂਕਿ ਜਿਹੜੇ ਇਹਨਾਂ ਦੇ ਨਾਵਲ ਨੇ ਇਹ ਔਰਤ ਦੀ ਸਥਿੱਤੀ ਨੂੰ ਓ ਦਰਸਾਉਂਦਾ ਹੈ ਉਹਦੀ ਅਸਲੀਅਤ ਹਾਲਤ ਕੀ ਹੈ ਉਸ ਨੂੰ ਦਰਸਾਉਂਦੇ ਹੈ ਜਿਵੇਂ ਕਿ ਇਹਨਾਂ ਦਾ ਇਕ ਨਾਵਲ ਹੈ ਇਹੋ ਹਮਾਰਾ ਜੀਵਨ ਹੈ ਇਹਦੇ ਵਿੱਚ ਇਸਤਰੀ ਦੀ ਦਿਸ਼ਾ ਦੱਸੀ ਜਾਂਦੀ ਹੈ ਕਿ ਉਹਦੇ ਨਾਲ ਬਚਪਨ ਵਿੱਚ ਬਚਪਨ ਤੋਂ ਲੈ ਕੇ ਬੁਢੇਪੇ ਤੱਕ ਉਹਦੇ ਵਿੱਚ ਉਹਦੇ ਨਾਲ ਕੀ ਕੀ ਬੀਤੀ ਹੈ ਇਸ ਤਰ੍ਹਾਂ ਇਹ ਜਿਹੜੀ ਸੱਚਾਈ ਆ ਇਹ ਸਾਰੀ ਸਾਰੇ ਹੀ ਪੰਜਾਬ ਦੀਆਂ ਔਰਤ ਦੀ ਸੱਚਾਈ ਨੂੰ ਪੇਸ਼ ਕਰਦੀ ਹੈ ਇਹੋ ਹਮਾਰਾ ਜੀਵਨ ਹੈ ਅਤੇ ਦਲੀਪ ਕੌਰ ਟਿਵਾਣਾ ਨੂੰ ਸਾਹਿਤ ਅਕੈਡਮੀ ਪੁਰਸਕਾਰ ਵੀ ਮਿਲਿਆ ਹੈ ਇਸ ਤਰ੍ਹਾਂ ਦਲੀਪ ਕੌਰ ਟਿਵਾਣਾ ਦੇ ਹੋਰ ਵੀ ਬਹੁਤ ਸਾਰੇ ਨਾਵਲ ਨੇ ਜਿਵੇਂ ਲੰਘਦੇ ਦਰਿਆ ਇਹਦੇ ਵਿੱਚ ਵੀ ਉਹਨਾਂ ਨੇ ਇਸਤਰੀ ਦੀ ਹਾਲਤ ਨੂੰ ਹੀ ਦਰਸਾਇਆ ਹੈ ਕਿ ਕਿਸ ਤਰ੍ਹਾਂ ਇਸਤਰੀ ਸਾਰੀ ਉਮਰ ਆਪਣੇ ਘਰ ਪਰਿਵਾਰ ਨੂੰ ਜੋੜ ਕੇ ਰੱਖਦੀ ਹੈ ਅਤੇ ਅੰਤ ਵਿੱਚ ਉਸਦੀ ਹਾਲਤ ਮਾੜੀ ਹੀ ਹੁੰਦੀ ਹੈ ਇਸ ਤਰ੍ਹਾਂ ਇਸ ਤਰ੍ਹਾਂ ਦਲੀਪ ਕੌਰ ਟਿਵਾਣਾ ਦੇ ਹੋਰ ਵੀ ਬਹੁਤ ਸਾਰੇ ਨਾਵਲ ਨੇ ਜਿਹੜੇ ਸਾਨੂੰ ਇਸਤਰੀ ਦੀ ਦੁਰਦਸ਼ਾ ਬਾਰੇ ਦੱਸਦੇ ਹਨ